ਸੋਲ੍ਹਾਂ ਦਸੰਬਰ ਦੋ ਹਜ਼ਾਰ ਸੱਤ ਸੱਤ ਨਵੰਬਰ ਦੋ ਹਜ਼ਾਰ ਚਾਰ ਇੱਕੀ ਨਵੰਬਰ ਦੋ ਹਜ਼ਾਰ ਦੋ ਪੱਚੀ ਦਸੰਬਰ ਉੱਨੀ ਸੌ ਇਕਿਆਸੀ ਚਾਰ ਅਗਸਤ ਦੋ ਹਜ਼ਾਰ ਦੋ ਨੌ